ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਕ ਆਰਥਕ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਵਪਾਰ ਅਤੇ ਵਣਜ ਵਿੱਚ ਜ ਜਿਵੇਂ ਵਪਾਰ ਵਿੱਚ ਵਪਾਰ ਵਿੱਚ ਪੰਜਾਬੀ ਬੋਲੀ ਦੀ ਵਰਤੋਂ ਕਰਨਾ ਬਹੁਤ ਹੀ ਸੋਖਾ ਹੋ ਜਾਂਦਾ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਕਰਕੇ ਉਹ ਸਾਰੇ ਹੀ ਅਰਾਮ ਨਾਲ ਸਮਝ ਜਾਂਦੇ ਹਨ ਜ਼ਰੂਰੀ ਨਹੀਂ ਹੈ ਕਿ ਜੋ ਬੰਦਾ ਵਪਾਰ ਕਰ ਰਿਹਾ ਹੈ ਉਸਨੂੰ ਹੋਰ ਭਾਸ਼ਾਵਾ ਵੀ ਆਉਂਦੀ ਹੋਵੇ ਹੋ ਸਕਦਾ ਹੈ ਕਿ ਉਹਨੇ ਸਿਰਫ਼ ਆਪਣੀ ਹਮੇਸ਼ਾ ਮਾਂ ਬੋਲੀ ਪੰਜਾਬੀ ਬਾਰੇ ਹੀ ਪੜ੍ਹਿਆ ਹੋਵੇ ਤਾਂ ਜੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਹੀ ਵਰਤੋਂ ਕਰਾਂਗੇ ਤਾਂ ਉਹ ਸਾਡੇ ਲਈ ਹੀ ਸੋਖਾ ਹੋਉਗਾ ਅਤੇ ਹੋਰਾਂ ਲਈ ਵੀ ਉਹ ਅਸਾਨੀ ਹੋਰਾਂ ਲਈ ਵੀ ਉਹ ਅਸਾਨ ਹੋ ਜਾਉਗਾ ਅਤੇ ਵ ਸਥਾਨਕ ਰੂਪ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇਖ ਜਿਵੇਂ ਅਸੀਂ ਦੇਖਦੇ ਜਾ ਰਹੇ ਹਨ ਲੋਕੀਂ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਹਨ ਅਤੇ ਸਥਾਨਕ ਭਾਸ਼ਾ ਵਿੱਚ ਪੰਜਾਬੀ ਭਾਸ਼ਾ ਸਥਾਨਕ ਤੌਰ 'ਤੇ ਅਲੱਗ ਅਲੱਗ ਜਗ੍ਹਾ 'ਤੇ ਬਦਲੀ ਜਾਂਦੀ ਹੈ ਕਿਤੇ ਮਾਲਵੀ ਕਿਤੇ ਦੁਆਬੀ ਬੋਲੀ ਜਾਂਦੀ ਹਨ ਇਸ ਤੋਂ ਇਸ ਲਈ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੀ ਵਰਤੋਂ ਜ਼ਿਆਦਾ ਕਰਾਂਗੇ ਤਾਂ ਉਸ ਨਾਲ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਹੀ ਪੰਜਾਬੀ ਭਾਸ਼ਾ 'ਤੇ ਪੰਜਾਬੀ ਕਲਚਰ ਬਾਰੇ ਪਤਾ ਲੱਗੂਗਾ